ਅਸੀਂ ਆਪਣੇ ਬਾਗ ਵਿੱਚ ਮਲਚ ਦੀ ਵਰਤੋਂ ਇਸ ਲਈ ਕਰਦੇ ਹਨ ਕਿ ਸਾਡੇ ਫੁੱਲ ਬੂਟੇ ਠੀਕ ਠਾਕ ਰਹਿਣ ਅਤੇ ਇਹਨਾਂ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਮਲਚ ਇੱਕ ਤਰ੍ਹਾਂ ਦਾ ਕੀੜਾ ਹੈ ਜੋ ਕਿ ਹੋਰ ਕੀੜੇ ਮਕੌੜਿਆਂ ਨੂੰ ਖਾ ਕੇ ਅਤੇ ਫੇਰ ਆਪਣ ਸਾਡੇ ਲਈ ਇਹ ਧਰਤੀ ਦੇ ਅੰਦਰ ਹੀ ਕੋਈ ਖਾਦ ਤਿਆਰ ਕਰਕੇ ਧਰਤੀ ਨੂੰ ਪੋਲਾ ਕਰਦਾ ਅਤੇ ਇਸਦਾ ਫੁੱਲ ਬੂਟਿਆਂ ਨੂੰ ਵਾਧੂ ਫਾਇਦਾ ਹੁੰਦਾ ਹੈ